ਰੂਪਨਗਰ ਜ਼ਿਲ੍ਹੇ ਵਿੱਚ ਮਨਾਏ ਜਾਣ ਵਾਲੇ ਮੁੱਖ ਸਮਾਗਮ ਨੇ ਲੋਹੜੀ ਵਿਸਾਖੀ ਅਤੇ ਸਭਾਵਾਂ ਸਭਾਵਾਂ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸਾਨੂੰ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ ਤਾਂ ਥਾਂ ਥਾਂ 'ਤੇ ਲੰਗਰ ਲੱਗਦੇ ਨੇ ਤਾਂ ਜਿਹੜੇ ਵਿਸਾਖੀ ਹੈ ਇਹਨਾਂ ਦੇ ਵੇਲੇ ਬੱਚੇ ਆਪਣੇ ਸਮ ਸਮਾਜਿਕ ਸਿੱਖਿਆਵਾਂ ਦੇ ਅਨੁਸਾਰ ਨੱਚਦੇ ਟੱਪਦੇ ਨੇ ਤਾਂ ਉਹ ਵੱਖ ਵੱਖ ਸਿੱਖਿਆਵਾਂ ਪ੍ਰਾਪਤ ਕਰਦੇ ਨੇ ਖਾਣ ਦੇ ਵੇਲੇ ਇੱਥੇ ਲੰਗਰ ਚੱਲਦੇ ਨੇ ਭਾਂਤ ਭਾਂਤ ਦੇ ਤਾਂ ਨਾਲੇ ਹੀ ਇਹ ਨਵੇਂ ਨਵੇਂ ਕੱਪੜੇ ਪਾਉਂਦੇ ਨੇ ਅਤੇ ਤਿਉਹਾਰਾਂ 'ਤੇ ਅਸੀਂ ਤਾਂ ਨਵੀਆਂ ਨਵੀਆਂ ਚੀਜ਼ਾਂ ਖਰੀਦਦੇ ਹਨ